ਹਾਂਜੀ ਸਾਨੂੰ ਖਬਰਾਂ ਸੁਣਨੀਆਂ ਅਤੇ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਅਸੀਂ ਆਰਥਿਕ ਖਬਰਾਂ ਬਾਰੇ ਨਿਊਜ਼ ਚੈਨਲ ਅਖਬਾਰ ਤੋਂ ਪੜ੍ਹ ਸਕਦੇ ਹਾਂ ਇਸ ਤੋਂ ਅਸੀਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਖਬਰਾਂ ਪੜ੍ਹ ਸਕਦੇ ਹਾਂ ਹਾਂਜੀ ਮੈਂ ਤੁਹਾਨੂੰ ਕੁਝ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਨਾਮ ਦੱਸ ਸਕਦੀ ਹਾਂ ਜਿਹਨਾਂ ਵਿੱਚੋਂ ਅਖਬਾਰਾਂ ਦੇ ਨਾਮ ਜੱਗ ਬਾਣੀ ਅਜੀਤ ਹਿੰਦੁਸਤਾਨ ਟਾਈਮਸ ਨਿਊਜ਼ ਟਵੈਂਟੀ ਫੋਰ ਏ ਬੀ ਪੀ ਨਿਊਜ਼ ਆਜ ਤੱਕ ਐਨ ਡੀ ਟੀ ਵੀ ਪੀ ਟੀ ਸੀ ਨਿਊਜ਼ ਹਨ ਜੋ ਸਾਨੂੰ ਆਰਥਿਕ ਖਬਰਾਂ ਬਾਰੇ ਜਾਣਕਾਰੀ ਦਿੰਦੇ ਹਨ ਜਿਹਨਾਂ ਤੋਂ ਅਸੀਂ ਘਰ ਬੈਠੇ ਹੀ ਖਬਰਾਂ ਸੁਣ ਸਕਦੇ ਹਾਂ ਜਿਸ ਤੋਂ ਸਾਨੂੰ ਦੇਸ਼ ਵਿਦੇਸ਼ ਦੀਆਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਮਿਲਦੀ ਹੈ ਧੰਨਵਾਦ ਜੀ